ਮੇਰੇ ਪਰਿਵਾਰ ਵਿੱਚ ਚਾਰ ਸਦੱਸਿਆ ਹਨ ਇੱਕ ਮੇਰੇ ਮਾਤਾ ਜੀ ਮੇਰੇ ਪਿਤਾ ਜੀ ਮੇਰੀ ਵੱਡੀ ਭੈਣ ਅਤੇ ਮੇਰਾ ਇੱਕ ਛੋਟਾ ਭਰਾ ਹੈ ਮੇਰੇ ਪਿਤਾ ਜੀ ਪ੍ਰਾਈਵੇਟ ਨੌਕਰੀ ਕਰਦੇ ਹਨ ਮੇਰੇ ਵੱਡੀ ਭੈਣ ਕਾਲਜ ਵਿੱਚ ਬੀ ਕੌਮ ਕਰ ਰਹੀ ਹੈ ਮੇਰਾ ਛੋਟਾ ਭਰਾ ਦਸਵੀਂ ਜਮਾਤ ਵਿੱਚ ਪੜ੍ਹਦਾ ਹੈ ਮੇਰੇ ਦੋਸਤਾਂ ਵਿੱਚ ਮੇਰੀ ਇੱਕ ਪੱਕੀ ਸਹੇਲੀ ਜਿਸ ਦਾ ਨਾਮ ਅੰਜਲੀ ਹੈ ਉਹ ਇਸ ਸਮੇਂ ਬਾਰ ਬਾਰ੍ਹਵੀਂ ਜਮਾਤ ਕਰ ਰਹੀ ਹੈ